ਹੈਲੋ ਹਾਂਜੀ ਮੈਂ ਮੈਂ ਭਾਅ ਜੀ ਤੁਹਾਡਾ ਆਟੋ ਕਰਨਾ ਚਾਹੁੰਦੀ ਹਾਂ ਮੈਂ ਕਿਸੇ ਦੇ ਸੰਸਕਾਰ 'ਤੇ ਜਾਣਾ ਮੇਰੀਆਂ ਲੱਤਾਂ ਨਹੀਂ ਚਲਦੀਆਂ ਮੈਂ ਤੁਰ ਨਹੀਂ ਸਕਦੀ ਮੈਂ ਆਪਣੇ ਸਮੇਂ ਸਿਰ ਪੁੱਜਣਾ ਇਸ ਕਾਰਣ ਮੈਂ ਤੁਹਾਡਾ ਆਟੋ ਕੀਤਾ ਮੈਨੂੰ ਪੈਸੇ ਦੱਸ ਦਿਓ ਕਿੰਨੇ ਪੈਸੇ ਲੈਣੇ ਤੁਸੀਂ

ਨਾਲੇ ਦੱਸ ਦਿਓ ਕਿ ਕਿੰਨਾ ਕੁ ਟਾਈਮ ਲੱਗੇਗਾ ਨਵੀਂ ਸੜਕ ਬਣੀ ਹੈ ਏ ਇਹਦਾ ਮੈਨੂੰ ਕੋਈ ਆਈਡੀਆ ਨਹੀਂ ਹੈ ਕਿੰਨਾ ਕਿੰਨਾ ਟਾਈਮ ਲੱਗਦਾ ਤੁਹਾਨੂੰ ਤਾਂ ਸਭ ਪਤਾ ਹੀ ਹੈ ਨਾ ਹਾਂਜੀ ਤੁਸੀਂ ਆਟੋ ਚਲਾਉਂਦੇ ਹੋ ਨਾ ਅਤੇ ਮੈਨੂੰ ਕੋਈ ਪਤਾ ਨਹੀਂ ਆ ਹਾਂਜੀ ਦੱਸੋ ਮੈਨੂੰ ਕਿੰਨਾ ਟਾਈਮ ਲੱਗਿਆ ਅਤੇ ਕਿੰਨੇ ਪੈਸੇ ਤੁਸੀਂ ਲੈਣੇ ਨੇ ਮੈਂ ਹਰ ਵਾਰ ਤੁਹਾਡਾ ਹੀ ਆਟੋ ਲਵਾਂਗੀ ਹਾਂਜੀ ਤੁਹਾਡੀ ਸਰਵਿਸ ਬਹੁਤ ਚੰਗੀ ਹੈ ਆ ਮੈਨੂੰ ਸਮੇਂ ਸਿਰ ਪਹੁੰਚਾ ਦਿਓ ਤੁਸੀਂ ਬਸ ਸੰਸਕਾਰ 'ਤੇ ਲੇਟ ਹੋਣਾ ਚੰਗਾ ਨਹੀਂ ਨਾ ਲੱਗਦਾ ਹਾਂਜੀ ਹਾਂਜੀ ਮੈਂ ਤਾਂ ਕਰਕੇ ਤੁਹਾਨੂੰ ਪੁੱਛ ਰਹੀ ਹਾਂ ਬਤਾ ਦਿਓ ਮੁਝੇ ਬਹੁਤ ਧੰਨਵਾਦ ਤੁਹਾਡਾ ਹੋਵੇਗਾ